ਜੀ ਪੁਰਾਣੇ ਜਿਹੜੇ ਨਾਚ ਸੀ ਨਾ ਉਹ ਬਹੁਤ ਵਧੀਆ ਸੀ ਜਿਸ ਤਰ੍ਹਾਂ ਕਿ ਸੱਭਿਆਚਾਰਕ ਗਿੱਧਾ ਹੋ ਗਿਆ ਭੰਗੜਾ ਹੋ ਗਿਆ ਬਹੁਤ ਵਧੀਆ ਨਾਚ ਸੀ ਅਤੇ ਜਿਹੜੇ ਜਿੱਦਾਂ ਕਿ ਹੁਣ ਅੱਜ ਕੱਲ੍ਹ ਸਾਡੇ ਨਾਚ ਵਿੱਚ ਕਾਫੀ ਫਰਕ ਆ ਚੁੱਕਿਆ ਹੈ ਡਾਂਸਿੰਕ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ ਸਿੱਖਣ ਲਈ ਲੋਕ ਨਵੇਂ ਤੋਂ ਨਵਾਂ ਅੱਜ ਕੱਲ੍ਹ ਡਾਂਸਿੰਗ ਕਲਾਸਾਂ ਲਗਾਉਂਦੇ ਹਨ ਅਤੇ ਨਵਾਂ ਡਾਂਸਿੰਗ ਸਿੱਖਦੇ ਹਨ ਅਤੇ ਜਿਸ ਤਰ੍ਹਾਂ ਕਿ ਪੁਰਾਣੇ ਸੱਭਿਆਚਾਰਕ ਮੇਲੇ ਹੁੰਦੇ ਸੀ ਵਿਆਹ ਸ਼ਾਦੀਆਂ ਹੁੰਦੀਆਂ ਸਨ ਉਹਨਾਂ ਵਿੱਚ ਗਿੱਧੇ ਅਤੇ ਭੰਗੜੇ ਨੂੰ ਬਹੁਤ ਹੀ ਮਹੱਤਤਾ ਦਿੱਤੀ ਜਾਂਦੀ ਹੈ ਜੋ ਪੁਰਾਣੇ ਵਿਆਹ ਸ਼ਾਦੀਆਂ ਵਿੱਚ ਸੱਭਿਆਚਾਰਕ ਮੇਲੇ ਅਤੇ ਭੰਗੜੇ ਗਿੱਧੇ ਹੁੰਦੇ ਸੀ ਉਹਨਾਂ ਨੂੰ ਵੇਖਣ ਨਾਲ ਬਹੁਤ ਵਧੀਆ ਲੱਗਦਾ ਸੀ ਬਹੁਤ ਮਜ਼ਾ ਆਉਂਦਾ ਸੀ ਵੇਖ ਕੇ ਉਹਨਾਂ ਨੂੰ ਜੋ ਅੱਜ ਕੱਲ੍ਹ ਉਹਦਾ ਡਾਂਸ ਆ ਨਾ ਉਹ ਵੀ ਬਹੁਤ ਵਧੀਆ ਵਾ ਲੇਕਿਨ ਪੁਰਾਣਾ ਵੀ ਵਧੀਆ ਬਹੁਤ ਜ਼ਿਆਦਾ ਹੀ ਵਧੀਆ ਸੀ ਅੱਜ ਕੱਲ੍ਹ ਨਵੇਂ ਨਾਚਾਂ ਵਿੱਚ ਨਵਾਂ ਨਵਾਂ ਫੈਸ਼ਨ ਨਵਾਂ ਨਵਾਂ ਡਾਂਸਿੰਗ ਕਲਾਸਾਂ ਬਹੁਤ ਵਧੀਆ ਲੱਗਦੀਆਂ ਅੱਜ ਕੱਲ੍ਹ ਵੀ ਜੋ ਪੁਰਾਣਾ ਸੀ ਉਹ ਖਾਸ ਕਰਕੇ ਕੁਛ ਜ਼ਿਆਦਾ ਵਧੀਆ ਸੀ ਉਹਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਖਾਸ ਕਰਕੇ ਗਿੱਧੇ ਭੰਗੜੇ ਨੂੰ ਅਤੇ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਉਹ ਸੱਭਿਆਚਾਰਕ ਮੇਲੇ ਜੋ ਵਧੀਆ ਲੱਗਦੇ ਸੀ ਬਹੁਤ ਹੀ ਚੰਗੇ ਅਤੇ ਵਧੀਆ ਨਾਚ ਹੁੰਦੇ ਸੀ ਪੁਰਾਣੇ